ਇੱਕ ਅਪ੍ਰੈਲ ਦੋ ਹਜ਼ਾਰ ਬਾਈ ਚੌਦ੍ਹਾਂ ਨਵੰਬਰ ਦੋ ਹਜ਼ਾਰ ਵੀਹ ਪੰਦਰਾਂ ਅਪ੍ਰੈਲ ਦੋ ਹਜ਼ਾਰ ਇੱਕੀ ਛੱਬੀ ਜੂਨ ਦੋ ਹਜ਼ਾਰ ਵੀਹ ਸਤਾਈ ਅਕਤੂਬਰ ਦੋ ਹਜ਼ਾਰ ਬਾਰਾਂ